ਪਾਸੇ ਦੇ ਕਾਰੋਬਾਰ ਕਈ ਕਰ ਸਕਦੇ ਹਾਂ ਪਸ਼ੂ ਪਾਲਣ ਦੇ ਨਾਲ ਬਹੁਤ ਕੰਮ ਕਰੇ ਜਾ ਸਕਦੇ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਕੰਮ ਤਾਂ ਇੱਕ ਹੈ ਖਾਦ ਤਿਆਰ ਕਰਨਾ ਜਿਹੜੇ ਪਸ਼ੂ ਲੋਕ ਰੱਖਦੇ ਹਨ ਜਾਨਵਰ ਰੱਖਦੇ ਹਨ ਉਹਨਾਂ ਦੇ ਗੋਬਰ ਤੋਂ ਗੋਹੇ ਤੋਂ ਉਹਨਾਂ ਤੋਂ ਇੱਕ ਤਰ੍ਹਾਂ ਦੇ ਇੱਕ ਖਾਦ ਤਿਆਰ ਕਰੀ ਜਾਂਦੀ ਹੈ ਜਿਹੜੀ ਕਿ ਫ਼ਸਲਾਂ ਦੇ ਵਿੱਚ ਸਬਜ਼ੀਆਂ ਦੇ ਵਿੱਚ ਬੂਟਿਆਂ ਦੇ ਵਿੱਚ ਪਾਈ ਜਾ ਸਕਦੀ ਆ ਅਤੇ ਉਹ ਲੋਕ ਪਾਉਂਦੇ ਨੇ ਅਤੇ ਉਹ ਦੇਸੀ ਖਾਦ ਉਹਦਾ ਬਹੁਤ ਜ਼ਿਆਦਾ ਉਹਨੂੰ ਬੈਨੀਫਿੱਟ ਹੁੰਦਾ ਪੇੜ ਪੌਦਿਆਂ ਨੂੰ ਅਤੇ ਉਸਦੇ ਬਾਅਦ ਲੋਕ ਸ ਇਹ ਕਿੱਤੇ ਦੇ ਨਾਲ ਨਾਲ ਸਬਜ਼ੀ ਦਾ ਕਿੱਤਾ ਵੀ ਕਰ ਸਕਦੇ ਹਨ ਵੇਚ ਸਕਦੇ ਹਨ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਬਹੁਤ ਚੰਗਾ ਮੁਨਾਫ਼ਾ ਤੇ ਹੋ ਸਕਦਾ ਹੈ ਤਿਲ ਕਈ ਲੋਕ ਖੇਤੀ ਕਰਦੇ ਹਨ ਖੇਤੀ ਵੀ ਇਸ ਕਿੱਤੇ ਦੇ ਨਾਲ ਨਾਲ ਬਹੁਤ ਹੀ ਚੰਗਾ ਅਤੇ ਪੈਸੇਦਾਇਕ ਕੰਮ ਹੈ ਬੜਮੁੱਲਾ ਕੰਮ ਹੈ ਅਤੇ ਇਸ ਦੇ ਨਾਲ ਨਾਲ ਲੋਕ ਗੰਡੋਇਆ ਪਾਲਣ ਵੀ ਕਰ ਸਕਦੇ ਹਨ ਗੰਡੋਇਆ ਦੇ ਨਾਲ ਵੀ ਬਹੁਤ ਵਧੀਆ ਖਾਦ ਤਿਆਰ ਕੀਤੀ ਜਾਂਦੀ ਆ ਬਹੁਤ ਲੋਕ ਹਨ ਜਿਹੜੇ ਕਿ ਇਹ ਚੀਜ਼ਾਂ ਦੇ ਨਾਲ ਨਾਲ ਇਹ ਕਿੱਤੇ ਅਪਣਾਉਂਦੇ ਹਨ ਹੋਰ ਫ਼ਲ ਵੀ ਲਾ ਸਕਦੇ ਹਨ ਫ਼ਲਾਂ ਦੇ ਨਾਲ ਵੀ ਉਹਨਾਂ ਦੀ ਚੰਗੀ ਆਮਦਨ ਹੋ ਸਕਦੀ ਹੈ ਹੈ ਨਾ ਅਤੇ ਆਪਣਾ ਉਸ ਤੋਂ ਬਾਅਦ ਲੋਕ ਆਪਣੀ ਜਿਵੇਂ ਕਈ ਕਿੱਲ੍ਹੇ ਲੋਕਾਂ ਦੇ ਕਈ ਵਾਰੀ ਵਿਹਲੇ ਖੜ੍ਹੇ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਉਹ ਆਪਣੇ ਪੇੜ ਪੌਦੇ ਲਗਾ ਸਕਦੇ ਨੇ ਅਤੇ ਜਦੋਂ ਉਹ ਦੋ ਸਾਲਾਂ ਚਾਰ ਸਾਲਾਂ ਪੰਜ ਸਾਲਾਂ ਦੇ ਬਾਅਦ ਜਦੋਂ ਉਹ ਤਿਆਰ ਹੋ ਜਾਂਦੇ ਨੇ ਉਹਨਾਂ ਦੀ ਕਟਾਈ ਕਰਕੇ ਉਹਨਾਂ ਦੀ ਲੱਕੜ ਦਾ ਮੁਨਾਫ਼ਾ ਉਹ ਫਾਇਦਾ ਖੱਟ ਸਕਦੇ ਹਨ ਇਸ ਤਰ੍ਹਾਂ ਕਈ ਕਿੱਤੇ ਹਨ ਜਿਹੜੇ ਕਿ ਅਤੇ ਮੀਟ ਆਂਡੇ ਦੁੱਧ ਦੇ ਨਾਲੋਂ ਵਾਧੂ ਉਤਪਾਦਕ ਸਭ ਤੋਂ ਵਧੀਆ ਘਿਓ ਵੀ ਹੈ ਜਿਸਦੀ ਮਾਤਰਾ ਲੋਕ ਸ ਤਕਰੀਬਨ ਸਾਰੇ ਵਰਤਦੇ ਹਨ ਜਿਹੜਾ ਕਿ ਦੇਸੀ ਅਤੇ ਸ਼ੁੱਧ ਦਾਣੇਦਾਰ ਘਿਓ ਘਰ ਤਿਆਰ ਕੀਤਾ ਜਾਂਦਾ ਹੈ ਉਸ ਦੀ ਬਰਾਬਰੀ ਬਾਹਰ ਦੇ ਆਮ ਬਜ਼ਾਰੂ ਘਿਓ ਦੇ ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਤਾਕਤਵਰ ਹੁੰਦਾ ਹੈ